ਲੋ ਮੈਂ ਤੁਹਾਨੂੰ ਕੌਲ ਕਰਕੇ ਕੈਬ ਬੁੱਕ ਕੀਤੀ ਸੀ ਕਾਲਜ ਨੂੰ ਜਾਣ ਵਾਸਤੇ ਪਰ ਤੁਸੀਂ ਹਾਲੇ ਤੱਕ ਪਹੁੰਚੇ ਹੀ ਨਹੀਂ ਮੈਂ ਤੁਹਾਡੀ ਬਹੁਤ ਸਮੇਂ ਤੋਂ ਉਡੀਕ ਕਰ ਰਹੀ ਹਾਂ ਤੁਸੀਂ ਮੈਨੂੰ ਸਹੀ ਸਮਾਂ ਦੱਸੋ ਕਿ ਤੁਸੀਂ ਮੇਰੇ ਕੋਲ ਕਦੋਂ ਪਹੁੰਚੋਗੇ ਤਾਂ ਜੋ ਮੈਂ ਆਪਣੇ ਟੀਚਰਸ ਨੂੰ ਇਨਫੋਮ ਕਰ ਸਕਾਂ ਅਤੇ ਕਾਲਜ ਵਿੱਚ ਜਾ ਕੇ ਆਪਣੀਆਂ ਸਮੇਂ ਸਿਰ ਕਲਾਸਾਂ ਨੂੰ ਲਗਾ ਸਕਾਂ ਕ੍ਰਿਪਾ ਕਰਕੇ ਤੁਸੀਂ ਮੇਰੇ ਕੋਲ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰੋ ਤਾਂ ਜੋ ਮੈਂ ਸਮੇਂ ਸਿਰ ਆਪਣੇ ਕਾਲਜ ਪਹੁੰਚ ਕੇ ਕਲਾਸਾਂ ਨੂੰ ਲਗਾ ਸਕਾਂ